ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਰੋਪੜ ਤੋਂ ਰੇਲਵੇ ਸਟੇਸ਼ਨ 'ਚੋਂ ਬੋਲ ਰਹੇ ਆ ਰੇਲਵੇ ਮਾਸਟਰ ਜੀ ਅਤੇ ਸਰ ਜੀ ਮੈਂ ਦਿੱਲੀ ਨੂੰ ਜਾਣਾ ਸੀਗਾ ਜਿਹੜੀ ਆਪਣੇ ਹਫਤੇ ਬਾਅਦ ਜਾਂਦੀ ਆ ਟਰੇਨ ਜੀ ਦਿੱਲੀ ਨੂੰ ਅਤੇ ਇਹਦਾ ਕਿੰਨਾ ਕੁ ਕਦੋਂ ਕਿਹੜੇ ਟਾਇਮ ਆਉਂਦੀ ਆ ਜੀ ਹਾਂਜੀ ਹਾਂਜੀ ਅਤੇ ਇਹਦਾ ਜੀ ਫੇਰ ਆਪਣਾ ਕੋਈ ਵੇਰਵਾ ਜੀ ਕਿੱਦਾਂ ਇਹਦਾ ਵੇਰਵਾ ਕਿੱਦਾਂ ਟਿਕਟ ਆਪਣੀ ਹਾਂਜੀ

ਹਾਂਜੀ ਅੱਛਾ ਜੀ ਅਤੇ ਆਪਣੀ ਹੋਰ ਵੀ ਕੋਈ ਹੈਗੀ ਹੈ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਠੀਕ ਹੈ ਜੀ ਅਤੇ ਜੀ ਫਿਰ ਜਦੋਂ ਆਪਾਂ ਨੇ ਜੀ ਉੱਧਰ ਤੋਂ ਆਉਣਾ ਦਿੱਲੀ ਤੋਂ ਜੀ ਅੱਛਾ ਜੀ ਅਤੇ ਉਹਦਾ ਆਪਣਾ ਜੀ ਟਿਕਟ ਕਿੱਦਾਂ ਜੀ ਸੇਮ ਹੈ ਜੀ ਅੱਛਾ ਜੀ ਅਤੇ ਆਪਾਂ ਜੇ ਇਹ 'ਚ ਖਾਣਾ ਪਾਣੀ ਆਪਾਂ ਨੂੰ ਮਿਲ ਜੂਗਾ ਵਿੱਚ ਅਤੇ ਜਾਂ ਆਪਾਂ ਨੂੰ ਅਲੱਗ ਤੋਂ ਲੈ ਕੇ ਆਉਣਾ ਪੈਣਾ ਜੀ ਬਰੇਕਫਾਸਟ ਹੈ ਜੀ ਇਹਦੇ ਵਿੱਚੇ ਹੋ ਜਾਂਦਾ ਜੀ ਠੀਕ ਆ ਜੀ ਠੀਕ ਆ ਅਤੇ ਸਹੀ ਹੈ ਨਾ ਜੀ ਫਿਰ ਇਹ ਹਾਂ ਠੀਕ ਹੈ ਜੀ ਅੱਛਾ ਜੀ ਅਤੇ ਕਿੰਨੇ ਟਾਈਮ ਪਹਿਲਾਂ ਬੁੱਕ ਕਰਵਾਉਣੀ ਪੈਂਦੀ ਜੀ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਹਫਤਾ ਪਹਿਲਾਂ ਬੁੱਕ ਕਰਾ ਲਵਾਂਗੇ ਜੀ ਆਪਾਂ ਚਲੋ ਸਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ